ਸਤਾਈ ਜੁਲਾਈ ਦੋ ਹਜ਼ਾਰ ਇੱਕ ਛੇ ਜਨਵਰੀ ਦੋ ਹਜ਼ਾਰ ਛੇ ਸੱਤ ਜੁਲਾਈ ਦੋ ਹਜ਼ਾਰ ਅੱਠ ਅੱਠ ਨਵੰਬਰ ਦੋ ਹਜ਼ਾਰ ਦਸ ਇੱਕ ਜਨਵਰੀ ਦੋ ਹਜ਼ਾਰ ਚੌਵੀ